ਹਾਂਜੀ ਸਰ ਸਤਿ ਸ਼੍ਰੀ ਅਕਾਲ ਸਰ ਅਤੇ ਜੇ ਤੁਹਾਨੂੰ ਯਾਦ ਹੋਏਗਾ ਕੱਲ੍ਹ ਤੁਹਾਡੇ ਕੋਲ ਸਮਾਨ ਖੜ ਕੇ ਗਏ ਸੀ ਥੋੜ੍ਹਾ ਜਿਹਾ ਸਰ ਔਡਰ ਆਈ ਡੀ ਨੋਟ ਡਾਊਨ ਕਰ ਲਓ ਮੇਰੀ ਔਡਰ ਆਈ ਡੀ ਹੈ ਵੰਨ ਸੈਵਨ ਏਟ ਨਾਈਨ ਸਿਕਸ ਟੂ ਡਬਲ ਥ੍ਰੀ ਫੋਰ ਹਾਂਜੀ ਸਰ ਸਰ ਮੈਂ ਤੁਹਾਡੇ ਤੋਂ ਕੱਲ੍ਹ ਦੋ ਡੱਬੇ ਕੋਨ ਫਲੇਕ ਲੈ ਕੇ ਗਿਆ ਸੀ ਅਤੇ ਇੱਕ ਆਪਣੇ ਪੈਟ ਵਾਸਤੇ ਪੈਡੀਗੀਰੀ ਲੈ ਕੇ ਗਿਆ ਸੀ ਦੇਖਿਓ ਸਰ ਓਕੇ ਸਰ ਦੇਖਿਓ ਹੈਗੇ ਆ ਸਰ ਹਾਂਜੀ ਮੈਂ ਵੀ ਸਰ ਤਾਂਹੀਓ ਫੋਨ ਕੀਤਾ ਸੀ ਸਰ ਜਾਂ ਤਾਂ ਤੁਸੀਂ ਮੇਰੇ ਪੈਸਿਆਂ ਦਾ ਰਿਫੰਡ ਦੇ ਦਿਓ ਅਤੇ ਜਾਂ ਜੇ ਤੁਹਾਡੇ ਕੋਲ ਨਵਾਂ ਮਾਲ ਆਇਆ ਤਾਂ ਤੁਸੀਂ ਉਹਦੀ ਜਗ੍ਹਾ ਨਵਾਂ ਮਾਲ ਦੇ ਦਿਓ

ਜੀ ਸਰ

ਓਕੇ ਕੋਈ ਗੱਲ ਨਹੀਂ ਸਰ ਓਕੇ ਸਰ ਥੈਂਕਯੂ ਸਰ ਬੜੀ ਮਿਹਰਬਾਨੀ